ਪੰਜਾਬ ਵਿੱਚ ਜਿੱਦਾਂ ਕਿ ਹੁਣੇ ਅਸੀਂ ਗੱਲ ਕੀਤੀ ਕਿ ਬੱਚਿਆਂ ਨੂੰ ਕਿੱਦਾਂ ਪ੍ਰਭਾਵਿਤ ਕਰਦੀ ਹੈ ਸਿੱਖਿਆ ਪ੍ਰਣਾਲੀ ਉੱਦਾਂ ਕਿ ਅਸੀਂ ਦੇਖਿਆ ਜਾਵੇ ਤਾਂ ਅਧਿਆਪਕਾਂ ਦਾ ਵੀ ਇੱਥੇ ਕੋਈ ਹਾਲ ਨਹੀਂ ਹੈ ਅਧਿਆਪਕ ਨੂੰ ਵੀ ਪੂਰੀ ਇੱਕ ਉਹ ਪੇ ਨਹੀਂ ਮਿਲਦੀ ਜਿਹਦੇ ਕਰਕੇ ਉਹ ਬੱਚਿਆਂ ਉੱਤੇ ਘੱਟ ਧਿਆਨ ਦਿੰਦੇ ਆ ਉਹ ਕੰਮ ਕਰਨ ਤੋਂ ਪਿੱਛੇ ਹੁੰਦੇ ਆ ਅਗਰ ਅਧਿਆਪਕਾਂ ਨੂੰ ਸਹੀ ਪੇ ਮਿਲੇ ਸਹੀ ਉਹਨਾਂ ਦੀ ਰਿਸਪੈਕਟ ਹੋਵੇ ਉਹਨਾਂ ਦੀ ਕਦਰ ਕੀਤੀ ਜਾਵੇ ਤੋ ਸਿਕਸ਼ਾ ਕਿੰਨੀ ਅੱਗੇ ਵੱਧ ਸਕਦੀ ਹੈ ਪਰ ਜਿੱਦਾਂ ਕਿ ਦੇਖਿਆ ਜਾਂਦਾ ਹੈ ਹੁਣ ਅੱਜ ਦੇ ਸਕੂਲਾਂ ਦੇ ਵਿੱਚ ਇੰਨੀ ਕੁ ਟੀਚਰ ਕੁਆਲੀਫਾਈਡ ਨਹੀਂ ਹੁੰਦੇ ਪਰ ਉਹਨਾਂ ਨੂੰ ਹ ਅੱਛੀਆਂ ਵੱਡੀਆਂ ਵੱਡੀਆਂ ਪੋਸਟਾਂ ਦਿੱਤੀਆਂ ਜਾਂਦੀਆਂ ਪਰ ਜਿਹੜੇ ਕੁਆਲੀਫਾਈਡ ਟੀਚਰ ਹੈ ਉਹਨਾਂ ਨੂੰ ਕੋਈ ਕਦਰ ਨਹੀਂ ਕੀਤੀ ਜਾਂਦੀ ਮੇਰੇ ਖਿਆਲ 'ਚ ਤੋ ਪੰਜਾਬ 'ਚ ਸਿੱਖਿਆ ਪ੍ਰਣਾਲੀ ਬਹੁਤ ਹੀ ਪਿਛੜ ਗਈ ਹੋਈ ਹੈ ਜਿੱਥੇ ਕਿ ਕੋਈ ਬੱਚਿਆਂ ਦੇ ਕੋਈ ਟੀਚਰਾਂ ਦੀ ਕੋਈ ਬੱਚੇ ਵੀ ਟੀਚਰਾਂ ਦੀ ਕੋਈ ਰਿਸਪੈਕਟ ਨਹੀਂ ਕਰਦੇ